ਭਾਰਤ ਵਿੱਚ ਬਹੁਤ ਹੀ ਆਵਾਜਾਈ ਦੇ ਸਾਧਨ ਹਨ ਜਿਵੇਂ ਜਹਾਜ਼ ਮੋਟਰਸਾਈਕਲ ਗੱਡੀਆਂ ਬੱਸਾਂ ਕਾਰਾਂ ਮੋਟਰਸਾਈਕਲ ਸਾਈਕਲ ਆਵਾਜਾਈ ਦੇ ਬਹੁਤ ਸਾਧਨ ਹਨ ਜਿਨ੍ਹਾਂ ਵਿੱਚ ਬਹੁਤ ਭੀੜ ਜਿਵੇਂ ਬੱਸਾਂ ਹੋਈਆਂ ਜਿਵੇਂ ਟਰੇਨਾਂ ਇਨ੍ਹਾਂ ਵਿੱਚ ਬਹੁਤ ਹੀ ਭੀੜ ਭੜੱਕਾ ਹੁੰਦਾ ਹੈ ਅਤੇ ਯਾਤਰੀ ਇਨ੍ਹਾਂ ਵਿੱਚ ਬਹੁਤ ਹੀ ਮੁਸ਼ਕਲਾਂ ਨਾਲ ਜਾਂਦੇ ਹਨ ਜੋ ਆਮ ਆਮ ਮੋਟਰਸਾਈਕਲ ਹਨ ਉਹ ਆਵਾਜਾਈ ਦੇ ਨੋਰਮਲ ਸਾਧਨਾਂ ਨਾਲ ਆਪਣੇ ਘਰਾਂ ਕੋਲ਼ ਜਿਵੇਂ ਘਰਾਂ ਵਿੱਚ ਯੂਜ਼ ਕੀਤੇ ਜਾਂਦੇ ਹਨ ਸਾਈਕਲ ਮੋਟਰਸਾਈਕਲ ਇਨ੍ਹਾਂ 'ਤੇ ਲੋਕ ਆਮ ਤਰੀਕੇ ਨਾਲ਼ ਘਰ ਤੋਂ ਚਲੇ ਜਾਂਦੇ ਹਨ